ਹੈਲੋ ਹਾਂਜੀ ਤੁਸੀਂ ਸਵਿਗੀ ਤੋਂ ਗੱਲ ਕਰ ਰਹੇ ਹੋ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕੱਲ ਅਸੀਂ ਇੱਕ ਆਰਡਰ ਕੀਤਾ ਸੀ ਜਿਸ ਵਿੱਚ ਪਿਜ਼ਾ ਅਤੇ ਬਰਗਰ ਸਨ ਜੋ ਵਿਅਕਤੀ ਸਾਡਾ ਆਰਡਰ ਲੈ ਕੇ ਆਇਆ ਸੀ ਉਸਦਾ ਨਾਮ ਸੁਖਵਿੰਦਰ ਸਿੰਘ ਸੀ ਪਹਿਲੀ ਗੱਲ ਤਾਂ ਸਾਡਾ ਆਰਡਰ ਉਸ ਵਿਅਕਤੀ ਦੁਆਰਾ ਸਹੀ ਸਮੇਂ 'ਤੇ ਨਹੀਂ ਪਹੁੰਚਾਇਆ ਗਿਆ ਸੀ ਜੋ ਸਮਾਂ ਸਾਨੂੰ ਦੱਸਿਆ ਗਿਆ ਸੀ ਸਾਡਾ ਆਰਡਰ ਉਸ ਸਮੇਂ ਤੋਂ ਦੇਰੀ ਨਾਲ ਪਹੁੰਚਿਆ ਸੀ ਅਤੇ ਉਸ ਵਿਅਕਤੀ ਦੀਆਂ ਹਰਕਤਾਂ ਵੀ ਸਾਡੇ ਨਾਲ ਕੁਝ ਸਹੀ ਨਹੀਂ ਸਨ ਜਦੋਂ ਅਸੀਂ ਉਸ ਨੂੰ ਬਿੱਲ ਦੱਸਣ ਬਾਰੇ ਕਿਹਾ ਤਾਂ ਉਹ ਸਾਡੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜੋ ਕਿ ਸਾਨੂੰ ਬਿਲਕੁਲ ਸਹੀ ਨਹੀਂ ਲੱਗੀਆਂ ਉਸ ਦਾ ਇਹ ਵਿਵਹਾਰ ਦੇਖ ਕੇ ਸਾਨੂੰ ਕੁਝ ਠੀਕ ਨਹੀਂ ਲੱਗਿਆ ਅਤੇ ਉਹ ਸਾਡਾ ਨੰਬਰ ਵੀ ਮੰਗ ਰਿਹਾ ਸੀ ਤੁਹਾਡੇ ਡਿਲੀਵਰੀ ਪਾਰਟਨਰ ਦੀ ਇਹ ਅਸ਼ਲੀਲ ਹਰਕਤਾਂ ਬਾਰੇ ਅਸੀਂ ਸ਼ਿਕਾਇਤ ਦਰਜ ਕਰਾਉਣਾ ਚਾਹੁੰਦੇ ਹਾਂ ਅਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਡਿਲੀਵਰੀ ਕੰਪਨੀ ਵਿੱਚ ਕੁਝ ਇਦਾਂ ਦੇ ਲੋਕ ਕੰਮ ਕਰਦੇ ਹਨ ਉਹਨਾਂ ਬਾਰੇ ਕੁਝ ਸਖਤ ਕਦਮ ਚੁੱਕਿਆ ਜਾਵੇ ਅਤੇ ਇਸ ਚੀਜ਼ ਬਾਰੇ ਕੋਈ ਉਪਰਾਲਾ ਕੀਤਾ ਜਾਵੇ ਅਤੇ ਸਾਡੀ ਸ਼ਿਕਾਇਤ ਹੈ ਜੋ ਤੁਹਾਡੇ ਡਲੀਵਰੀ ਪਾਰਟਨਰ ਦੀ ਇਹ ਦਰਜ ਕੀਤੀ ਜਾਵੇ ਧੰਨਵਾਦ